ਜਦੋਂ ਮੈਂ ਆਪਣੇ ਬਾਗ ਦੇ ਵਿੱਚ ਲਗਾਏ ਹੋਏ ਪੌਦਿਆਂ ਅਤੇ ਰੁੱਖਾਂ ਨੂੰ ਖਿੜਦੇ ਹੋਏ ਅਤੇ ਲਹਿਰਾਉਂਦੇ ਹੋਏ ਵੇਖਦਾ ਹਾਂ ਤਾਂ ਮੈਂ ਬਹੁਤ ਸੋਹਣਾ ਮਹਿਸੂਸ ਕਰਦਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਅਤੇ ਮੈਨੂੰ ਖੁਸ਼ੀ ਵੀ ਹੁੰਦੀ ਹੈ ਕਿ ਮੇੇਰੇ ਦੁਆਰਾ ਲਗਾਏ ਹੋਏ ਪੌਦੇ ਬਹੁਤ ਸੋਹਣੇ ਪੈਦਾ ਹੋਏ ਹਨ ਅਤੇ ਬਹੁਤ ਸਾਰੇ ਖਿੜੇ ਹੋਏ ਹਨ ਜਿਨ੍ਹਾਂ ਵਿੱਚੋਂ ਗੁਲਾਬ ਦੇ ਫੁੱਲ ਜਦੋਂ ਮੈਂ ਖਿੜੇ ਹੋਏ ਵੇਖਦਾ ਹਾਂ ਤਾਂ ਮੈਨੂੰ ਬਹੁਤ ਅਨੰਦ ਦਿੰਦੇ ਹਨ ਅਤੇ ਮੇਰਾ ਮੁੱਖ ਦੇ ਉੱਤੇ ਮੇਰੇ ਦੇ ਉੱਤੇ ਸ ਇੱਕ ਬਹੁਤ ਸਾਰੀ ਖੁਸ਼ੀ ਆ ਜਾਂਦੀ ਹੈ